ਸਾਡੇ ਖੇਤਰ ਵਿੱਚ ਜਦੋਂ ਵੀ ਕੋਈ ਇਕੱਠ ਹੁੰਦਾ ਹੈ ਤਾਂ ਪੁਲਿਸ ਆਮ ਤੌਰ 'ਤੇ ਉਹਦੇ ਵਿੱਚ ਸਾ ਸ਼ਾਮਿਲ ਜ਼ਰੂਰ ਹੁੰਦੀ ਹੈ ਜਿੱਦਾਂ ਅਸੀਂ ਦੇਖਦੇ ਹਾਂ ਜਦੋਂ ਵੀ ਕੋਈ ਨਗਰ ਕੀਰਤਨ ਹੁੰਦਾ ਹੈ ਜਾਂ ਫਿਰ ਕੋਈ ਬਹੁਤ ਵੱਡੇ ਧੂਮ ਧਾਮ ਨਾਲ ਕੋਈ ਤਿਉਹਾਰ ਜਾਂ ਸ਼ਹੀਦੀ ਸਮਾਗਮ ਜਾਂ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਤਾਂ ਪੁਲਿਸ ਨੂੰ ਜ਼ਰੂਰ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਕਿ ਕੋਈ ਅਪਰਾਧ ਜਾਂ ਦੁਰਘਟਨਾ ਨਾ ਹੋ ਸਕੇ ਆਮ ਤੌਰ 'ਤੇ ਨਾਕਿਆਂ 'ਤੇ ਪੁਲਿਸ ਖੜ੍ਹਦੀ ਹੈ ਤਾਂ ਕਿ ਜੋ ਕੋਈ ਵੀ ਨਿਯਮਾਂ ਦੀ ਉਲੰਘਣਾ ਨਾ ਕਰ ਸਕੇ ਅਤੇ ਦੁਰਘਟਨਾਵਾਂ ਨਾ ਵਾਪਰਨ ਜਦੋਂ ਅਸੀਂ ਸੁਰੱਖਿਆ ਦੀ ਗੱਲ ਦੇਖਦੇ ਹਾਂ ਤਾਂ ਚਾਹੀਦਾ ਹੈ ਕਿ ਨਿਆਂ ਪ੍ਰਣਾਲੀ ਸਭ ਦੇ ਲਈ ਬਰਾਬਰ ਹੋਵੇ ਕੋਈ ਵੀ ਜੇ ਕੋਈ ਜ਼ੁ ਜ਼ੁਲਮ ਕਰਦਾ ਹੈ ਤਾਂ ਉਸਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਧਰਮ ਜਾਤੀ ਜਾਂ ਵਰਗ ਦਾ ਹੋਵੇ ਅਹੁਦਿਆਂ ਨੂੰ ਵੀ ਮੱਦੇ ਨਜ਼ਰ ਨਹੀਂ ਰੱਖਣਾ ਚਾਹੀਦਾ ਜਦੋਂ ਕਿਸੇ ਜ਼ੁਲਮ ਦੀ ਸਜ਼ਾ ਦੇਣ ਦੀ ਗੱਲ ਆਉਂਦੀ ਹੈ ਅਤੇ ਰਿਸ਼ਵਤ ਦੀ ਜੋ ਗੱਲ ਹੈ ਉਹਨੂੰ ਵੀ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਇਹ ਰਿਸ਼ਵਤ ਜੋ ਹੈ ਇਹ ਬਹੁਤ ਲੋਕਾਂ ਦੇ ਨਾਲ ਗਲਤ ਕੰਮਾਂ ਹੋ ਹੋ ਜਾਂਦੇ ਹਨ ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਅਪਰਾਧ ਅਤੇ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਜਾਗਰੂਕ ਕਰਨ ਅਤੇ ਆਮ ਤੌਰ 'ਤੇ ਫਤਿਹਗੜ੍ਹ ਸਾਹਿਬ ਵਿੱਚ ਪੁਲਿਸ ਮਾਰਚ ਵੀ ਕੱਢਦੀ ਹੁੰਦੀ ਹੈ ਜਦੋਂ ਵੀ ਨਗਰ ਕੀਰਤਨ ਹੋਣ ਜਾ ਰਹੇ ਹੁੰਦੇ ਹਨ ਤਾਂ ਜੋ ਲੋਕ ਜਾਗਰੂਕ ਹੋ ਸਕਣ ਅਤੇ ਉਹਨਾਂ ਉੱਤੇ ਪੁਲਿਸ ਦੇ ਪ੍ਰਭਾਵ ਦਾ ਦਬਕਾ ਵੀ ਪੈ ਸਕੇ